ਹੈਲੋ ਹਾਂਜੀ ਹਾਂਜੀ ਉੱਧਰੋਂ ਹੀ ਬੋਲ ਰਹੀ ਹਾਂ ਹਾਂਜੀ ਮੇਰੇ ਕੋਲ ਪਿਆ ਇੱਕ ਸਾਡਾ ਦੂਸਰੇ ਘਰ ਦੂਸਰਾ ਘਰ ਹੈ ਨਾ ਜਿਹੜਾ ਅਸੀਂ ਰਹਿੰਦੇ ਕਿਤੇ ਹੋਰ ਹਾਂ ਅਤੇ ਸਾਡਾ ਇੱਕ ਹੋਰ ਘਰ ਹੈਗਾ ਉਹ ਅਸੀਂ ਕਿਰਾਏ 'ਤੇ ਦੇਣਾ ਸਾਡਾ ਨਾ ਜਿਵੇਂ ਮਕਾਨ ਬਣਿਆ ਹੋਇਆ ਡਬਲ ਸਟੋਰੀ ਮਕਾਨ ਹੈਗਾ ਹੈ ਨੀਚੇ ਹੈਗੇ ਹੈ ਇੱਕ ਸਟੋਰ ਹੈ ਕਿਚਨ ਹੈ ਵੋਸ਼ਰੂਮ ਹੈਗੇ ਹੈ ਦੋ ਠੀਕ ਹੈ ਅਤੇ ਦੋ ਕਮਰੇ ਇੱਕ ਡਰਾਇੰਗ ਰੂਮ ਹੈ ਇੱਕ ਹਾਂ ਇੱਕ ਲੋਬੀ ਹੈ ਠੀਕ ਹੈ ਬਾਹਰ ਪਾਰਕਿੰਗ ਏਰੀਆ ਵੀ ਹੈਗਾ ਉੇੇਹਦੇ ਉੱਤੇ ਉਹਦੇ ਵਿੱਚ ਤੁਸੀਂ ਆਪਣੀ ਕਾਰ ਵਗੈਰਾ ਖੜ੍ਹਾ ਸਕਦੇ ਹੋ ਠੀਕ ਹੈ ਅਤੇ ਨਾਲ ਛੋਟਾ ਜਿਹਾ ਲੋਨ ਵੀ ਹੈਗਾ ਹਾਂ ਅਤੇ ਐਂਵੇ ਹੀ ਉੱਪਰ ਬਣਿਆ ਹੋਇਆ ਜਿਵੇਂ ਨੀਚੇ ਬਣਿਆ ਹੋਇਆ ਉਵੇਂ ਹੀ ਉੱਪਰ ਬਣਿਆ ਹੋਇਆ ਹੈ ਤੁਸੀਂ ਕ ਤੁਹਾਡੀ ਕੀ ਮਤਲਬ ਚਾਹੁੰਦੇ ਹੋ ਤੁਸੀਂ ਕਿਹੜਾ ਡਬਲ ਲੈਣਾ ਚਾਹੁੰਦੇ ਹੋ ਕਿ ਇੱਕ ਨੀਚੇ ਵਾਲਾ ਸਿਰਫ਼ ਸਿੰਗਲ ਪੋਰਸ਼ਨ ਲੈਣਾ ਚਾਹੁੰਦੇ ਹੋ ਅੱਛਾ ਫੇਰ ਤਾਂ ਤੁਸ ਹਾਂਜੀ ਅੱਛਾ ਠੀਕ ਹੈ ਬਸ ਫੇਰ ਤੁਹਾਨੂੰ ਉਹਦੀ ਦੱਸ ਤਾ ਕੀ ਕੁਛ ਹੈਗਾ ਅਤੇ ਤੁਸੀਂ ਜਿਨ੍ਹਾਂ ਨਾਲ ਗੱਲ ਕਰਨੀ ਹੈ ਉਨ੍ਹਾਂ ਨਾਲ ਵੀ ਸਲਾਹ ਕਰਕੇ ਦੱਸ ਦਿਓ ਸਾਨੂੰ ਹੈ ਨਾ ਇਹਦਾ ਕੀ ਹਾਂਜੀ ਇਹਦਾ ਅਸੀਂ ਮਹੀਨੇ ਦਾ ਲੈਂਦੇ ਹਾਂ ਦਸ ਹਜ਼ਾਰ ਨੀਚੇ ਵਾਲੇ ਪੋਰਸ਼ਨ ਇੱਕ ਪੋਰਸ਼ਨ ਦਾ ਦਸ ਹਜ਼ਾਰ ਨਹੀਂ ਨਹੀਂ ਜੀ ਅਸੀਂ ਵੈਸੇ ਤਾਂ ਪਹਿਲਾਂ ਪੰਦਰਾਂ ਲੈਂਦੇ ਸੀਗੇ ਪਰ ਤੁਸੀਂ ਕਹਿ ਰਹੇ ਹੋ ਬਈ ਅਸੀਂ ਦੋ ਜਣੇ ਹਾਂ ਫੈਮਲੀਜ ਨੇ ਲੈਣਾ ਤਾਂ ਅਸੀਂ ਦਸ ਦਾ ਨੀਚੇ ਰੱਖ ਲਿਆ ਅਤੇ ਦਸ ਦਾ ਉੱਪਰ

ਹਾਂਜੀ ਵੇਖ ਲਓ ਅਸੀਂ ਨਾ ਜ਼ਿਆਦਾ ਤਾਂ ਨਹੀਂ ਮੰਗਿਆ ਵੈਸੇ ਅਸੀਂ ਨੌਂ ਕੁ ਹਜ਼ਾਰ ਤੱਕ ਕਰ ਸਕਦੇ ਹਾਂ ਇਹ ਤੋਂ ਜ਼ਿਆਦਾ ਘੱਟ ਤਾਂ ਨਹੀਂ ਹੋ ਸਕਦਾ ਹਾਂਜੀ ਹਾਂਜੀ ਨੌਂ ਹੀ ਉਤਲਿਆਂ ਵਾਸਤੇ

ਨਹੀਂ ਤੁਸੀਂ ਭਾਵੇਂ ਇੰਸਟੋਲਮੈਂਟ ਦੇ ਵਿੱਚ ਦੇ ਦੇਣਾ ਚਾਹੇ ਇਕੱਠੇ ਵੀ ਦੇ ਸਕਦੇ ਹੋ ਅਤੇ ਜੇ ਚਾਹੋ ਤਾਂ ਇੰਸਟੋਲਮੈਂਟ ਦੇ ਵਿੱਚ ਵੀ ਦੇ ਦੇਣਾ ਹਾਂਜੀ ਹਾਂਜੀ ਤੁਸੀਂ ਮੈਨੂੰ ਫੋਨ ਕਰ ਦੇਣਾ ਜਿਵੇਂ ਤੁਹਾਡੀ ਸਲਾਹ ਹੋਈ ਹਾਂ ਠੀਕ ਹੈ ਜੀ ਓਕੇ